ਮੈਂ ਅਕਸਰ ਹੀ ਛੋਟੇ ਛੋਟੇ ਚੁਟਕਲੇ ਕਵਿਤਾਵਾਂ ਕਹਾਣੀਆਂ ਲਿਖਦੀ ਰਹਿੰਦੀ ਹਾਂ ਮੈਨੂੰ ਵਿਹਲੇ ਸਮੇਂ ਵਿੱਚ ਕੁਝ ਨਾ ਕੁਝ ਲਿਖਣਾ ਪਸੰਦ ਹੈ ਮੈਨੂੰ ਲਿਖਣ ਲਈ ਇਕ ਸ਼ਾਂਤ ਤੇ ਆਰਾਮਦਾਇਕ ਮਾਹੌਲ ਦੀ ਜਰੂਰਤ ਹੁੰਦੀ ਹੈ ਮੈਂ ਘਰ ਵਿੱਚ ਜਦੋਂ ਵੇਹਲੀ ਜਾਂ ਫਰੀ ਹੁੰਦੀ ਹਾਂ ਮੈਂ ਆਪਣੇ ਕਮਰੇ ਨੂੰ ਬੰਦ ਕਰਕੇ ਬੈਠ ਜਾਂਦੀ ਹਾਂ ਅਤੇ ਫੇਰ ਕੁਝ ਲਿਖਦੀ ਹਾਂ ਕਿਉਂਕਿ ਕੁਝ ਲਿਖਣ ਲਈ ਪਹਿਲਾਂ ਉਸਦੀ ਇਕ ਇਮੇਜ ਆਪਣੇ ਆਪਣੇ ਦਿਮਾਗ ਵਿੱਚ ਬਣਾਉਣੀ ਪੈਂਦੀ ਹੈ ਜੋ ਕਿ ਇਕ ਸ਼ਾਂਤ ਜਗਾ ਤੇ ਬਿਨਾਂ ਕਿਸੇ ਡਿਸਟਰਬੈਂਸ ਤੋਂ ਹੀ ਸੰਭਵ ਹੁੰਦੀ ਹੈ ਇਸ ਲਈ ਮੈਂ ਵੀ ਇੱਕ ਸ਼ਾਂਤ ਮਾਹੌਲ ਲੱਭ ਕੇ ਉਥੇ ਬੈਠ ਕੇ ਲਿਖਦੀ ਹਾਂ ਜਦੋਂ ਮੈਂ ਘਰ ਤੋਂ ਬਾਹਰ ਹੋਵਾਂ ਉਥੇ ਮੈਂ ਹਰ ਇਕ ਚੀਜ਼ ਹਰ ਨਜ਼ਾਰੇ ਸਭ ਕਾਸੇ ਬਹੁਤ ਤਿਆਰ ਨਾਲ ਵੇਖਦੀ ਹਾਂ ਉਹਨਾਂ ਨੂੰ ਸਮਝਦੀ ਹਾਂ ਤੇ ਹਰ ਇਕ ਚੀਜ਼ ਦਾ ਆਨੰਦ ਲੈਂਦੀ ਹਾਂ ਮੈਨੂੰ ਕਈ ਵਾਰ ਆਮ ਜ਼ਿੰਦਗੀ ਤੋਂ ਹੀ ਬਹੁਤ ਵਧੀਆ ਥੀਮ ਮਿਲ ਜਾਂਦਾ ਹੈ ਫੇਰ ਮੈਂ ਆਪਣੇ ਘਰ ਆ ਕੇ ਆਪਣੇ ਕਮਰੇ ਵਿੱਚ ਸ਼ਾਂਤ ਮਾਹੌਲ ਵਿੱਚ ਬੈਠ ਕੇ ਉਸ ਬਾਰੇ ਸੋਚ ਵਿਚਾਰ ਕਰਦੀ ਹਾਂ ਅਤੇ ਉਸ ਨੂੰ ਇੱਕ ਲਿਖਤ ਦਾ ਰੂਪ ਦਿੰਦੀ ਹਾਂ